ਚਿੱਤਰਕਾਰੀ ਇੱਕ ਬਹੁਤ ਹੀ ਸੋਹਣਾ ਹੁਨਰ ਹੈ ਜੋ ਕਿ ਮੈਨੂੰ ਲੱਗਦਾ ਹੈ ਅੱਜ ਦੀ ਜਨਰੇਸ਼ਨ ਦੇ ਵਿੱਚ ਜ਼ਰੂਰੀ ਜਿਹੜਾ ਵਿਸ਼ਾ ਹੈਗਾ ਉਹ ਵੀ ਕਰ ਦਿੱਤਾ ਗਿਆ ਹੈ ਸਕੂਲਾਂ ਦੇ ਵਿੱਚ ਇਸ ਦੇ ਨਾਲ ਬੱਚੇ ਦੀ ਰਚਨਾਤਮਕ ਕਲਪਨਾ ਦਾ ਪਤਾ ਲੱਗਦਾ ਹੈ ਉਹਦੇ ਕਲਪਨਾ ਦੇ ਵਿੱਚ ਉਗਾੜ ਆਉਂਦਾ ਹੈ ਅਤੇ ਇਸ ਤੋਂ ਇਲਾਵਾ ਉਹ ਬਹੁਤ ਚੀਜ਼ਾਂ ਇਹੋ ਜਿਹੀਆਂ ਸਿੱਖਦਾ ਹੈ ਜਿਹੜੀ ਕਿ ਉਸਦੇ ਮਾਪਿਆਂ ਨੂੰ ਵੀ ਸ਼ਾਇਦ ਨਾ ਆਉਂਦੀ ਹੋਵੇ ਅਤੇ ਇੱਕ ਜਿਹੜਾ ਸਿੱਖਣ ਸਿੱਖਣ ਦਾ ਚਾਹਵਾਨ ਹੁੰਦਾ ਹੈ ਉਹ ਹਮੇਸ਼ਾ ਇੰਨਾ ਕੁ ਜ਼ਿਆਦਾ ਡੁੱਬ ਕੇ ਸਿੱਖਦਾ ਹੈ ਉਹ ਕਿਸੇ ਵੀ ਚੀਜ਼ ਨੂੰ ਕਿ ਉਹ ਜਿਹੜਾ ਸਿਖਾਉਣ ਵਾਲਾ ਗੁਰੂ ਤੋਂ ਵੀ ਅੱਗੇ ਲੰਘ ਸਕਦਾ ਹੈ ਚਿੱਤਰਕਾਰੀ ਇੱਕ ਅਜਿਹੀ ਅਜਿਹਾ ਹੁਨਰ ਹੈ ਜਿਸ ਦੇ ਵਿੱਚ ਕਲਪਨਾ ਰਾਹੀਂ ਅਸੀਂ ਕੁਝ ਵੀ ਬਣਾ ਸਕਦੇ ਹਾਂ ਅਤੇ ਉਹ ਕਈ ਵਾਰੀ ਇੰਨੀ ਜ਼ਿਆਦਾ ਪ੍ਰਸਿੱਧ ਹੋ ਸਕਦੀ ਹੈ ਕਿ ਜਿਸ ਦੇ ਨਾਲ ਆਪਣਾ ਨਾਮ ਰੋਸ਼ਨ ਕੀਤਾ ਜਾ ਸਕਦਾ ਹੈ ਬਹੁਤ ਸਾਰੇ ਚਿੱਤਰਕਾਰ ਨੇ ਕਲਾਕਾਰ ਨੇ ਜਿਹੜੇ ਕਿ ਬਹੁਤ ਹੀ ਪ੍ਰਸਿੱਧ ਹੋਏ ਹਨ